ਅਸੀਂ ਸ਼ਿਮਲੇ ਜਾਂਦੇ ਹੋਏ ਇੱਕ ਵਾਰੀ ਜ਼ਿਆਦਾ ਜਾਮ ਹੋਣ ਕਰਕੇ ਪਿੰਡ ਵਾਲੇ ਕੱਚੇ ਰਾਹ ਪੈ ਗਏ ਅਤੇ ਜਾਂਦੇ ਜਾਂਦੇ ਅਸੀਂ ਇਹੋ ਜਿਹੇ ਅਨੁਭਵ ਕੀਤੇ ਜਿਹਨਾਂ ਵਿੱਚ ਛੋਟੇ ਤਲਾਬ ਝਰਨੇ ਅਤੇ ਫ਼ਲਾਂ ਦੇ ਬਾਗਾਂ ਨੇ ਸਾਡਾ ਧਿਆਨ ਆਪਣੇ ਵੱਲ਼ ਖਿੱਚਿਆ ਇਹਨਾਂ ਨੂੰ ਅਸੀਂ ਆਪਣੇ ਦੋਸਤਾਂ ਨਾਲ਼ ਕੈਮਰੇ ਵਿੱਚ ਕੈਦ ਕੀਤਾ ਇਹ ਬਹੁਤ ਹੀ ਖਾਸ ਅਨੁਭਵ ਸੀ ਜੋ ਕਿ ਸ਼ਿਮਲੇ 'ਚ ਵੀ ਐਨੇ ਮਨਮੋਹਕ ਦ੍ਰਿਸ਼ ਨਹੀਂ ਹਨ ਜਿਹੜੇ ਕਿ ਸ਼ਿਮਲੇ ਨੂੰ ਜਾਂਦੇ ਹੋਏ ਰਾਹ 'ਚ ਪਿੰਡਾਂ 'ਚ ਹਨ ਇੱਥੋਂ ਦੇ ਪਿੰਡਾਂ ਦੇ ਲੋਕ ਵੀ ਬਹੁਤ ਹੀ ਸਹਿਯੋਗੀ ਹਨ ਅਤੇ ਇਹਨਾਂ ਦ੍ਰਿਸ਼ਾਂ ਨੇ ਸਾਡੀ ਜ਼ਿੰਦਗੀ 'ਚ ਇੱਕ ਖਾਸ ਥਾਂ ਬਣਾ ਲਈ